ਹਾਂਜੀ ਸਾਡੇ ਖੇਤਰ ਦੇ ਵਿੱਚ ਮੁੱਖ ਕਿੱਤਾ ਜਿਹੜਾ ਹੈਗਾ ਕਿ ਕਿਰਤ ਦੇ ਜਾਂ ਰੁਜ਼ਗਾਰ ਦੇ ਜਿਹੜੇ ਖੇਤਰ ਨੇ ਉਹ ਖੇਤੀਬਾੜੀ ਅਤੇ ਖੇਤੀਬਾੜੀ ਕੰਸਟਰਕਸ਼ਨ ਐਗਰੀਕਲਚਰ ਕੰਸਟਰਕਸ਼ਨ ਸਰਵਿਸਿਜ਼ ਟੈਕਨੋਲੋਜੀ ਦੇ ਮਾਮਲੇ ਦੇ ਵਿੱਚ ਜਿਵੇਂ ਇੰਡਸਟਰੀ ਪੰਜਾਬ ਦੇ ਵਿੱਚ ਨਾ ਹੋਣ ਕਰਕੇ ਬੋਡਰ ਸਟੇਟ ਹੋਣ ਕਰਕੇ ਜਾਂ ਹੋਰ ਕਾਰਨਾਂ ਕਰਕੇ ਸਾਡੇ ਇੱਥੇ ਟੈਕਨੋਲੋਜੀ ਦੇ ਮਾਮਲੇ ਦੇ ਵਿੱਚ ਟੈਕਨੋਲੋਜੀ ਜਾਂ ਇੰਡਸਟਰੀ ਦਾ ਜਿਹੜਾ ਟਰੈਂਡ ਆ ਉਹ ਘੱਟ ਆ ਅਤੇ ਇਹ ਜਿਹੜਾ ਹੈਗਾ ਉਹ ਚੈਲੇਂਜ ਪੰਜਾਬ ਦੇ ਸਾਹਮਣੇ ਹੈਗਾ ਕਾਫੀ ਮਤਲਬ ਵੀ ਅਸੀਂ ਇੰਡਸਟਰੀ ਦੇ ਮਾਮਲੇ ਦੇ ਵਿੱਚ ਪਛੜਨ ਕਰਕੇ ਫਿਰ ਟੈਕਨੋਲੋਜੀ ਦੇ ਮਾਮਲੇ ਦੇ ਵਿੱਚ ਵੀ ਉਹਨੇ ਐਡਵਾਂਸ ਨਹੀਂ ਹੈਗੇ ਜਿੰਨਾਂ ਦੁਨੀਆਂ ਹੋ ਰਹੀ ਹੈ ਸਾਨੂੰ ਤਾਂ ਇਸ ਕਰਕੇ ਜਿਵੇਂ ਪੰਜਾਬ ਦੇ ਵਿੱਚ ਔਟੋਮੋਬਾਈਲ ਦਾ ਖੇਤਰ ਜਿਹੜਾ ਹੈਗਾ ਉਹਦੀ ਇੰਡਸਟਰੀ ਦੇ ਬੇਸਿਕਲੀ ਜਿਹੜੀ ਐਗਰੋ ਬੇਸਡ ਇੰਡਸਟਰੀ ਜਿਹੜੀ ਹੈ ਪੰਜਾਬ ਐਗਰੀਕਲਚਰ ਐਗਰੀਕਲਚਰ ਬੇਸਡ ਸਟੇਟ ਹੈਗਾ ਆ ਤਾਂ ਇੱਥੇ ਐਗਰੀਕਲਚਰ ਬੇਸਡ ਇੰਡਸਟਰੀ ਜਿਹੜੀ ਹੈ ਉਹ ਜ਼ਰੂਰ ਲੱਗਣੀ ਚਾਹੀਦੀ ਉਹਦੇ ਨਾਲ ਪੰਜਾਬ ਫਿਰ ਟੈਕਨੀਕਲੀ ਵੀ ਤਰੱਕੀ ਕਰੇਗਾ ਜੀ